ਜੇਕਰ ਅਸੀਂ ਅੱਜ ਦੀ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਪੂਰਾ ਹੀ ਸੰਸਾਰ ਟੈਕਨੋਲੋਜੀ ਦੇ ਰੂਪ ਵਿੱਚ ਦਿਨੋ ਦਿਨ ਵਾਧਾ ਕਰਦਾ ਜਾ ਰਿਹਾ ਹੈ ਤਾਂ ਜਿਵੇਂ ਸਾਨੂੰ ਪਹਿਲਾਂ ਕੱਪੜੇ ਧੋਣ ਨੂੰ ਕਿੱਥੇ ਦੋ ਤਿੰਨ ਘੰਟੇ ਲੱਗਦੇ ਸਨ ਪਰ ਹੁਣ ਢੇਰ ਢੇਰ ਕੱਪੜਿਆਂ ਦਾ ਮਸ਼ੀਨ ਦੇ ਵਿੱਚ ਅੱਧੇ ਘੰਟੇ ਵਿੱਚ ਧੋ ਹੋ ਜਾਂਦਾ ਹੈ ਇਸ ਤੋਂ ਇਲਾਵਾ ਕਿਤੇ ਸਫ਼ਰ ਕਰਨਾ ਹੋਵੇ ਤਾਂ ਸਾਨੂੰ ਪੈਦਲ ਜਾਣਾ ਪੈਂਦਾ ਸੀ ਜਾਂ ਇੱਕ ਦੋ ਦਿਨ ਕਿਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਨੂੰ ਲੱਗ ਜਾਂਦੇ ਸਨ ਪਰ ਅੱਜ ਦੀ ਟੈਕਨੋਲੋਜੀ ਦੇ ਕਾਰਨ ਇਹ ਹੁਣ ਸਾਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਣੀ ਮੰਜ਼ਿਲ ਤੱਕ ਪਹੁੰਚਾਇਆ ਜਾਂਦਾ ਹੈ